ਸਾਡੇ ਇਲਾਕੇ ਵਿੱਚ ਬਹੁਤ ਹੀ ਵਧੀਆ ਵਧੀਆ ਥਾਵਾਂ ਹਨ ਜੋ ਕੀ ਮੇਰੇ ਮਨ ਨੂੰ ਪ੍ਰਭਾਵਿਤ ਕਰਦੀਆਂ ਹਨ ਮੈਨੂੰ ਉਹਨਾਂ ਥਾਵਾਂ 'ਤੇ ਜਾਣਾ ਬਹੁਤ ਹੀ ਵਧੀਆ ਲੱਗਦਾ ਹੈ ਜਿਵੇਂ ਕਿ ਗੁਰਦੁਆਰਾ ਸਾਹਿਬ ਮੈਨੂੰ ਗੁਰਦੁਆਰੇ ਸਾਹਿਬ ਵਿੱਚ ਜਾ ਕੇ ਮੱਥਾ ਟੇਕਣਾ ਅਤੇ ਪੰਜ ਦਸ ਮਿੰਟ ਵਾਹਿਗੁਰੂ ਜੀ ਦਾ ਨਾਮ ਲੇਣਾ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਸ਼ੋਪਿੰਗ ਮਾਲ ਵਿੱਚ ਜਾ ਕੇ ਆਪਣਾ ਸਮਾਂ ਬਤੀਤ ਕਰਨਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ